ਹੈਲੋ ਮੈਂ ਆਪਣੇ ਨੇੜੇ ਦੀ ਦੁਕਾਨ ਤੋਂ ਇੱਕ ਸ਼ੈਂਪੁ ਖਰੀਦਿਆ ਹੈਂਡ ਐਂਡ ਸ਼ੋਲਡਰ ਜਿਸ ਨੂੰ ਇਸਤੇਮਾਲ ਕਰਨ ਨਾਲ ਰਿਜ਼ਲਟ ਬਹੁਤ ਵਧੀਆ ਰਿਹਾ ਵਾਲ਼ ਬਹੁਤ ਸੋਹਣੇ ਸੁੰਦਰ ਅਤੇ ਲੰਬੇ ਵੀ ਹੋਏ ਜਿਸ ਨਾਲ ਡੈਂਡਰਫ ਤਾਂ ਬਿਲਕੁਲ ਹੀ ਖਤਮ ਹੋ ਗਿਆ